ਜੀਵਨ ਵਿੱਚ ਜਿੱਦਾਂ ਵਚਨ ਵਧਨਾਵਾਂ ਹੈਗੀਆਂ ਘਰ ਦੇ ਕੰਮ ਕਈ ਸਾਰੇ ਹੁੰਦੇ ਪਰ ਫਿਰ ਵੀ ਬੰਦਾ ਆਪਣੇ ਵਾਸਤੇ ਥੋੜ੍ਹਾ ਟਾਈਮ ਤਾਂ ਕੱਢਦਾ ਹੀ ਹੈ ਇਹ ਟਾਈਮ ਮੈਂ ਮੈਂ ਮੋਸਟਲੀ ਕੱਢਦਾ ਹੁੰਦਾ ਵੀਕੈਂਡ ਪਰ ਅਤੇ ਹਫਤੇ ਦੇ ਆਖਰੀ ਜਿਹੜੇ ਦੋ ਚਾਰ ਦਿਨ ਹੁੰਦੇ ਉਹਨਾਂ 'ਚ ਜਾਂ ਫਿਰ ਕੋਈ ਗਰਮੀਆਂ ਦੀਆਂ ਛੁੱਟੀਆਂ ਆ ਜਾਂਦੀਆਂ ਨੇ ਅਤੇ ਕੋਈ ਤਿਉਹਾਰ ਦੀਆਂ ਛੁੱਟੀਆਂ ਆ ਗਈਆਂ ਤਿੰਨ ਜਾਂ ਚਾਰ ਉਹਨਾਂ ਵਿੱਚ ਅਸੀਂ ਪਲੈਨ ਬਣਾਉਂਦੇ ਮੈਂ ਅਤੇ ਮੇਰੇ ਦੋਸਤ ਅਸੀਂ ਪਿਛਲੇ ਪਿਛਲੀ ਵਾਰ ਸ਼ਿਮਲੇ ਥਰੂ ਗਏ ਤੇ ਅਸੀਂ ਅਤੇ ਸ਼ਿਮਲੇ ਨੂੰ ਗਏ ਉੱਥੇ ਅਸੀਂ ਟਰੈਕ ਦਾ ਆਨੰਦ ਮਾਣਿਆ ਉੱਥੇ ਇੱਥੇ ਤੋਂ ਅਸੀਂ ਲਗਭਗ ਬਾਈ ਤਰੀਕ ਨੂੰ ਗਏ ਤੇ ਜੋ ਟਰੈਕ ਦਾ ਨਜ਼ਾਰਾ ਜੋ ਪਹਾੜੀ ਚੜ੍ਹਾਈ ਦਾ ਨਜ਼ਾਰਾ ਉਹ ਕਿਤੇ ਹੋਰ ਪਾਸੇ ਨਹੀਂ ਹੈਗਾ ਉਹਦੇ ਵਿੱਚ ਅਸੀਂ ਇੱਕ ਇੱਕ ਬੈਗ ਪੈਕ ਕੀਤਾ ਬੜਾ ਸਾਰਾ ਜਿਹੜਾ ਕਿ ਟਰੈਕਿੰਗ ਵਾਸਤੇ ਸਪੈਸ਼ਲੀ ਹੁੰਦਾ ਅਤੇ ਉਹਦੇ ਵਿੱਚ ਅਸੀਂ ਮੈਂ ਅਤੇ ਮੈਂ ਦੋ ਦੋਸਤ ਹੋਰ ਸੀ ਅਸੀਂ ਸਾਰੇ ਇੱਕ ਹੋਰ ਮੰਡਲੀ ਨਾਲ ਮਿਲ ਕੇ ਲੇਕਿਨ ਜਿਹੜਾ ਗਾਈਡ ਹਾਇਰ ਕੀਤਾ ਉਹਦੇ ਨਾਲ ਅਸੀਂ ਗਏ ਤੇ ਅਸੀਂ ਬਹੁਤ ਘੁੰਮਦੇ ਘੁੰਮਾਉਂਦੇ ਬਹੁਤ ਸਾਰੇ ਪਹਾੜਾਂ 'ਚ ਲੰਘੇ ਬਹੁਤ ਸਾਰੇ ਜੰਗਲੀ ਜਾਨਵਰ ਵੀ ਦੇਖੇ ਦੇਖੇ ਪਰ ਦੂਰ ਤੋਂ ਹੀ ਆ ਪਰ ਬਹੁਤ ਵਧੀਆ ਮਜ਼ਾ ਆਇਆ ਐਟ ਦੀ ਐਂਡ ਲਾਸਟ ਵਿੱਚ ਜਾ ਕੇ ਅਸੀਂ ਅਖੀਰ ਵਿੱਚ ਅਸੀਂ ਇੱਕ ਟਰੈਕ ਆਪਣਾ ਵਿੱਚ ਰੀਫਰੈੱਸਮੈਂਟ ਵੀ ਸੀ ਖਾਣ ਪੀਣ ਨੂੰ ਵੀ ਤਾਂ ਘੰਟੇ ਦੇ ਘੰਟੇ ਦੋ ਦੋ ਘੰਟੇ ਬਾਅਦ ਲ ਅੰਤ ਵਿੱਚ ਜਾ ਕੇ ਅਸੀਂ ਤਾਂ ਫਿਰ ਇੱਕ ਐਂਦਾਂ ਦੀ ਜਗ੍ਹਾ ਪਰ ਅਸੀਂ ਆਪਣਾ ਟਰੈਕ ਖਤਮ ਕੀਤਾ ਜਿੱਥੇ ਕਿ ਬਹੁਤ ਸੋਹਣਾ ਜਿਹੜਾ ਸ ਸੰਨ ਸੈੱਟ ਦਾ ਵਿਊਜ ਸੰਨ ਸੈਟ ਦਾ ਵਿਊ ਅਸੀਂ ਦੇਖਿਆ ਇੰਨੀ ਹਾਈਟ ਉੱਪਰ ਜਾ ਕੇ ਸਾਰੇ ਥੱਲੇ ਪਹਾੜ ਇੱਦਾਂ ਲੱਗਦਾ ਕਿ ਅਸੀਂ ਧਰਤੀ ਦੀ ਜਿਹੜੀ ਉੱਚਾਈ ਪਰ ਪਹੁੰਚ ਗਏ ਜਿੱਥੇ ਅਸੀਂ ਸਭ ਤੋਂ ਉੱਪਰ ਇਸ ਤਰ੍ਹਾਂ ਬਹੁਤ ਸਾਰੀਆਂ ਬਹੁਤ ਸਾਰੀਆਂ ਯਾਦਾਂ ਸਨ ਇਹਦੇ ਨਾਲ